ਚਾਰ ਜਨਵਰੀ ਦੋ ਹਜ਼ਾਰ ਇੱਕ ਛੇ ਫਰਵਰੀ ਦੋ ਹਜ਼ਾਰ ਚਾਰ ਸੱਤ ਮਾਰਚ ਦੋ ਹਜ਼ਾਰ ਅੱਠ ਦੀ ਨਵੰਬਰ ਉੱਨੀ ਸੌ ਛਿਆਨਵੇਂ ਪੰਦਰਾਂ ਅਗਸਤ ਉੱਨੀ ਸੌ ਸੰਨਤਾਲੀ